ਹੈਲੋ ਸਤਿ ਸ਼੍ਰੀ ਅਕਾਲ ਦੀਦੀ ਜੀ ਅਸੀਂ ਤੁਹਾਡੇ ਨਵੇਂ ਮਹਿਮਾਨ ਤੁਹਾਡੇ ਗਆਂਢੀ ਨਵੇਂ ਏਰੀਏ 'ਚ ਆਏ ਹਾਂ ਜੀ ਪਹਿਚਾਣ ਲਿਆ ਤੁਸੀਂ ਅਸੀਂ ਤੁਹਾਡੇ ਘਰ ਕੋਲ ਹੀ ਤੁਹਾਡੇ ਨਾਲ ਸ਼ਿਫਟ ਹੋਏ ਹੈਗੇ ਹਾਂਜੀ ਮੈਨੂੰ ਇੱਥੋਂ ਦੇ ਬਠਿੰਡੇ ਬਾਰੇ ਕੁਛ ਘੱਟ ਹੀ ਪਤਾ ਗਾ ਤਾਂ ਤੁਸੀਂ ਥੋੜ੍ਹਾ ਜਿਹਾ ਦੱਸੋਗੇ ਵੀ ਬੱਚਿਆਂ ਦੀ ਬੁੱਕਸ ਵਗੈਰਾ ਕਿੱਥੋਂ ਖਰੀਦ ਸਕਦੇ ਹਾਂ ਸ਼ੋਪਿੰਗ ਵਗੈਰਾ ਦਾ

ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ

ਹਾਂਜੀ ਠੀਕ ਹੈ ਜੀ ਅੱਛਾ ਜੀ ਅਤੇ ਸ਼ੋਪਿੰਗ ਵਗੈਰਾ ਕਰਨੀ ਹੋਵੇ ਕਲੋਥ ਵਗੈਰਾ ਦੀ ਉ ਉਹ ਵਗੈਰਾ ਵੀ ਦੱਸ ਦਿਓ ਵੀ ਕਿੱਥੇ ਸ਼ੋਰੂਮ ਵਗੈਰਾ ਹੈਗੇ ਆ ਹਾਂਜੀ ਹਾਂਜੀ

ਹਾਂਜੀ ਠੀਕ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਹੋਰ ਘੁੰਮਣ ਵਾਸਤੇ ਆਪਣੇ ਮੋਲ ਵਗੈਰਾ ਕਿਹੜੀ ਸਾਈਡ ਹੈਗੇ

ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਹੋਰ ਦੀਦੀ ਜੀ ਬਸ ਤੁਹਾਡਾ ਵੈਸੇ ਸਮਝ ਆ ਗਿਆ ਆਹ ਜਿਹੜਾ ਤੁਸੀਂ ਦੱਸਿਆ ਵੀ ਸ਼ੋਪਿੰਗ ਮੋਲ ਲਈ ਇੱਧਰ ਉੱਧਰ ਹੈਗੇ ਹੈਗੇ ਸ਼ੁਕਰੀਆ ਵੈਸੇ ਤੁਹਾਡਾ ਆਇਓ ਕਦੇ ਸਾਡੇ ਘਰ